ਛੇ ਫਰਵਰੀ ਉੱਨੀ ਸੌ ਬਾਨਵੇਂ ਅਠਾਰਾਂ ਦਸੰਬਰ ਉੱਨੀ ਸੌ ਬਾਨਵੇਂ ਸੱਤ ਸਤੰਬਰ ਉੱਨੀ ਸੌ ਛਿਆਨਵੇਂ ਅਠਾਰਾਂ ਅਗਸਤ ਉੱਨੀ ਸੌ ਬਾਨਵੇਂ ਬਾਰਾਂ ਮਈ ਦੋ ਹਜ਼ਾਰ ਉੱਨੀ